ਕੀ ਕਦੇ ਤੁਸੀਂ ਬਾਈਕਿੰਗ ਦੌਰਾਨ ਕਿਸੇ ਰਾਹੀ ਨੂੰ ਸੀਟ ਦਿੱਤੀ ਹੈ ਉਸ ਨਾਲ ਤੁਹਾਡਾ ਸਫਰ ਕਿਵੇਂ ਕੱਟਿਆ ਆਪਣਾ ਅਨੁਭਵ ਸਾਂਝਾ ਕਰੋ ਹਾਂਜੀ ਮੈਨੂੰ ਯਾਦ ਹੈ ਕਿ ਮੈਂ ਇੱਕ ਵਾਰ ਮੈਂ ਪਿੰਡ ਤੋਂ ਸ਼ਹਿਰ ਵੱਲ ਬਾਈਕ 'ਤੇ ਜਾ ਰਿਹਾ ਸੀ ਰਸਤੇ ਵਿੱਚ ਇੱਕ ਬਜ਼ੁਰਗ ਮਾਤਾ ਜੀ ਪੈਦਲ ਤੁਰੇ ਜਾ ਰਹੇ ਹਨ ਸਨ ਤਾਂ ਉਹਨਾਂ ਨੂੰ ਦੇਖ ਕੇ ਮੇਰਾ ਦਿਲ ਭਰ ਆਇਆ ਮੈਂ ਆਪਣੀ ਬਾਈਕ ਰੋਕ ਕੇ ਉਹਨਾਂ ਨੂੰ ਪੁੱਛਿਆ ਕਿ ਉਹ ਕਿੱਥੇ ਜਾ ਰਹੇ ਹਨ ਉਹਨਾਂ ਨੇ ਦੱਸਿਆ ਕਿ ਉਹਨਾਂ ਨੂੰ ਸ਼ਹਿਰ ਵਿੱਚ ਆਪਣੇ ਪੁੱਤਰ ਕੋਲ ਜਾਣਾ ਹੈ ਪਰ ਉਹਨਾਂ ਕੋਲ ਕੋਈ ਸਾਧਨ ਨਹੀਂ ਹੈ ਮੈਂ ਉਹਨਾਂ ਨੂੰ ਆਪਣੀ ਵਾਈਕ 'ਤੇ ਬਿਠਾ ਲਿਆ ਰਸਤੇ ਵਿੱਚ ਅਸੀਂ ਬਹੁਤ ਗੱਲਾਂ ਕੀਤੀਆਂ ਉਹਨਾਂ ਨੇ ਮੈਨੂੰ ਆਪਣੇ ਪਿੰਡ ਦੀਆਂ ਗੱਲਾਂ ਸੁਣਾਈਆਂ ਅਤੇ ਮੈਂ ਉਹਨਾਂ ਨੂੰ ਸ਼ਹਿਰ ਬਾਰੇ ਦੱਸਿਆ ਸਾਨੂੰ ਪਤਾ ਨਹੀਂ ਪਤਾ ਹੀ ਨਹੀਂ ਲੱਗਿਆ ਕਿ ਸਫਰ ਕਦੋਂ ਖਤਮ ਹੋ ਗਿਆ ਉਹਨਾਂ ਨੂੰ ਉਹਨਾਂ ਦੇ ਪੁੱਤਰ ਦੇ ਘਰ ਛੱਡ ਕੇ ਮੈਨੂੰ ਬਹੁਤ ਖੁਸ਼ੀ ਹੋਈ ਇਹ ਇੱਕ ਅਜਿਹਾ ਅਨੁਭਵ ਸੀ ਜੋ ਇਹ ਮੈਂ ਕਦੇ ਨਹੀਂ ਭੁੱਲ ਸਕਦਾ ਧੰਨਵਾਦ